ਹਾਂਜੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਜਿਹੜਾ ਪੰਜਾਬੀ ਸੱਭਿਆਚਾਰ ਦੇ ਵਿੱਚ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਪੰਜਾਬੀ ਸੱਭਿਆਚਾਰ ਦਾ ਇਹ ਨਾ ਅਨਿੱਖੜਵਾਂ ਅੰਗ ਹੈਗਾ ਦੀ ਵਿਲੱਖਣ ਹੀ ਇਹਦੀ ਮਹੱਤਤਾ ਹੈਗੀ ਅਤੇ ਇਹ ਨਾ ਹੌਲੀ ਹੌਲੀ ਹੈ ਨਾ ਜਿਹੜਾ ਇਹ ਪੰਜਾਬੀ ਸੱਭਿਆਚਾਰ ਦਾ ਇਹ ਮਹੱਤਵਪੂਰਨ ਹਿੱਸਾ ਵੀ ਬਣਿਆ ਹੈਗਾ ਉਹ ਕਿਵੇਂ ਬਣਿਆ ਹੈਗਾ ਉਹ ਮੈਂ ਤੁਹਾਨੂੰ ਦੱਸ ਦੱਸਦਾਂਗਾ ਵੀ ਸਭ ਤੋਂ ਵੱਧ ਤਾਂ ਇਹ ਖੁਸ਼ੀ ਦਾ ਪ੍ਰਗਟਾਵਾ ਹੁੰਦਾ ਭੰਗੜਾ ਜਿਹੜਾ ਖੁਸ਼ੀ ਉਤਸ਼ਾਹ ਅਤੇ ਜਸ਼ਨ ਦਾ ਪ੍ਰਤੀਕ ਹੈ ਇਹ ਪੰਜਾਬੀਆਂ ਦੇ ਮਿਲਣਸਾਰ ਅਤੇ ਖੁਸ਼ਮਿਜਾਜੀ ਸ਼ਖਸੀਅਤ ਨੂੰ ਦਰਸਾਉਂਦਾ ਹੈਗਾ ਕਈ ਵਾਰ ਕੀ ਹੈ ਵੀ ਜਦੋਂ ਦੋ ਪੰਜਾਬੀ ਮਿਲ ਜਾਂਦੇ ਆ ਤਾਂ ਉਹ ਦੂਰੋਂ ਭੱਜ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਭੰਗੜਾ ਪਾ ਕੇ ਮਿਲਦੇ ਨੇ ਠੀਕ ਹੈ ਅਤੇ ਜੇ ਆਪਾਂ ਕਿਸਾਨੀ ਸੱਭਿਆਚਾਰ ਦੇ ਨਾਲ ਇਹਦਾ ਜੋੜ ਕੇ ਦੇਖੀਏ ਤਾਂ ਇਹਨੂੰ ਕੀ ਹੈ ਭੰਗੜਾ ਜਿਹੜਾ ਮੂਲ ਕਿਸਾਨੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਫਸਲਾਂ ਦੀ ਵਾਢੀ ਤਿਉਹਾਰਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ 'ਤੇ ਕਿਸਾਨ ਭੰਗੜੇ ਪਾ ਕੇ ਖੁਸ਼ੀ ਦਾ ਜਿਹੜਾ ਪ੍ਰਗਟਾਵਾਂ ਕਰਦੇ ਨੇ ਜਿਵੇਂ ਵਿਸਾਖੀ ਆਉਣ ਵੇਲੇ ਨਾ ਵੀ ਜੱਟਾ ਆਈ ਵਿਸਾਖੀ ਹੋ ਹੋ ਹੋ ਇੱਦਾਂ ਦੇ ਗੀਤ ਗਾਉਂਦੇ ਨੇ ਨਾ ਆਪਾਂ ਵੇਖਦੇ ਹੈਗੇ ਤਾਂ ਜਿਹੜਾ ਵਿਸਾਖੀ ਦੇ ਨਾਲ ਭੰਗੜਾ ਕਿੰਨਾ ਵਧੀਆ ਜੁੜਿਆ ਹੋਇਆ ਹੈਗਾ ਅਤੇ ਹੋਰ ਜਿਵੇਂ ਲੋਹੜੀ ਦੇ ਮੌਕੇ 'ਤੇ ਹੌਲੀ ਦੇ ਮੌਕੇ 'ਤੇ ਇਸ ਯਾਨੀ ਕੇ ਸਾਰੇ ਤਿਉਹਾਰਾਂ ਵੇਲੇ ਹੀ ਪੰਜਾਬੀ ਦਾ ਨਾਂ ਖੁਸ਼ ਹੋ ਕੇ ਭੰਗੜਾ ਪਾਉਂਦੇ ਨੇ ਨਿੱਕੀ ਨਿੱਕੀ ਗੱਲ 'ਤੇ ਹੀ ਪਾ ਲੈਂਦੇ ਆ ਬਸ ਜਦੋਂ ਖੁਸ਼ ਹੋਣ ਸਾਡੀ ਸਰੀਰਕ ਸਿਹਤ ਦੇ ਲਈ ਵੀ ਇਹ ਬਹੁਤ ਵਧੀਆ ਹੈਗਾ ਇਹ ਸਰੀਰਕ ਕਸਰਤ ਕਰਨ ਵਾਲਾ ਨਾਚ ਹੈ ਇਹ ਬੰਦੇ ਨੂੰ ਜਿਹੜਾ ਤੰਦਰੁਸਤ ਰੱਖਦਾ ਹੈ ਮਨ ਨੂੰ ਸਾਫ ਰੱਖਦਾ ਹੈਗਾ ਅਤੇ ਆਪਣੇ ਸਮਾਜਿਕ ਹੈ ਇੱਕ ਇਹਦਾ ਬੰਧਨਾਂ ਦੇ ਵਿੱਚ ਵੀ ਆਪਾਂ ਨੂੰ ਜਕੜ ਕੇ ਰੱਖਦਾ ਹੈਗਾ ਜਿਵੇਂ ਭੰਗੜਾ ਪਾਉਣ ਦੇ ਨਾਲ ਲੋਕ ਇੱਕ ਦੂਜੇ ਦੇ ਨੇੜੇ ਆਉਂਦੇ ਆ ਅਤੇ ਆਪਣਾ ਜਿਹੜਾ ਸਮਾਜਿਕ ਬੰਧਨ ਹੈ ਜਿਹੜਾ ਮਜ਼ਬੂਤ ਹੁੰਦਾ ਹੈਗਾ ਪੰਜਾਬੀ ਸੱਭਿਆਚਾਰ ਦੀ ਪਛਾਣ ਹੈਗਾ ਜਿਹੜਾ ਭੰਗੜਾ ਹੈਗਾ ਪੰਜਾਬੀ ਸੱਭਿਆਚਾਰ ਦੀ ਇੱਕ ਵਿਲੱਖਣ ਪਛਾਣ ਹੈਗਾ ਦੁਨੀਆ ਭਰ ਦੇ ਵਿੱਚ ਜਿਹੜਾ ਕਿ ਇਹਦੀ ਪਛਾਣ ਦਵਾਉਂਦਾ ਜਿਵੇਂ ਅੱਜ ਕੱਲ੍ਹ ਆਪਣੇ ਪੰਜਾਬੀ ਦੇ ਸਿੰਗਰ ਹੈਗੇ ਉਹ ਡਾਂਸਰ ਵੀ ਹੈ ਫਿਲਮਾਂ ਵਿੱਚ ਕੇ ਦਲਜੀਤ ਦੋਸਾਂਝ ਜੀ ਉਹਨਾਂ ਦਾ ਜਿਹੜਾ ਭੰਗੜਾ ਹੈਗਾ ਇੰਟਰਨੈਸ਼ਨਲ ਲੈਵਲ 'ਤੇ ਉਹ ਆਪਣੇ ਪੰਜਾਬ ਦੇ ਭੰਗੜੇ ਨੂੰ ਲੈ ਕੇ ਗਏ ਹੈ ਆਪਾਂ ਤਾਂ ਉਹਨਾਂ ਦਾ ਦੇਣ ਵੀ ਨਹੀਂ ਦੇ ਸਕਦੇ ਇਸ ਜਿਹੜਾ ਭੰਗੜਾ ਹੈਗਾ ਆਪਣੇ ਇੰਟਰਨੈਸ਼ਨਲ ਲੈਵਲ 'ਤੇ ਵੀ ਗਿਆ ਹੋਇਆ ਹੈਗਾ ਅਤੇ ਜੇ ਆਪਾਂ ਗੱਲ ਕਰੀਏ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਤਾਂ ਹੈਗਾ ਹੀ ਹੈਗਾ ਇਹ ਪੇਂਡੂ ਇਲਾਕਿਆਂ ਦੇ ਵਿੱਚ ਜਿੰਨੇ ਤਿਉਹਾਰ ਮਨਾਏ ਜਾਂਦੇ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਭੰਗੜਾ ਹੈਗਾ ਬਹੁਤ ਵਧੀਆ ਢੰਗ ਦੇ ਨਾਲ ਪਾਇਆ ਜਾਂਦਾ ਹੈਗਾ ਵਿਸ਼ਵਵਿਆਪੀ ਵੀ ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ ਜਿਹੜੀ ਦਲਜੀਤ ਦੋਸਾਂਝ ਦੀ ਉਹ ਆਪਾਂ ਤੁਹਾਨੂੰ ਜਿਹੜਾ ਕੀ ਹੈ ਹੁਣ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹੈਗਾ ਜਿਹੜਾ ਪੰਜਾਬੀ ਤਿਉਹਾਰਾਂ ਨੂੰ ਮਨਾਉਣ ਦੇ ਲਈ ਦੁਨੀਆਂ ਦੇ ਕੋਨੋ ਕੋਨੇ 'ਚ ਲੋਕ ਇਕੱਠੇ ਹੁੰਦੇ ਨੇ ਹੈ ਨਾ ਭੰਗੜਾ ਪਾਉਂਦੇ ਨੇ ਨਵੀਆਂ ਪੀੜ੍ਹੀਆਂ ਨੂੰ ਜੋੜਦਾ ਹੈਗਾ ਇਹ ਆਪਸ ਵਿੱਚ ਨਾ ਜਿਵੇਂ ਪੁਰਾਣਿਆਂ ਨੂੰ ਦੇਖ ਦੇਖ ਕੇ ਜਿਹੜੇ ਨਵੇਂ ਹੈਗੇ ਉਹ ਵੀ ਸਿੱਖਦੇ ਨੇ ਠੀਕ ਹੈ ਭੰਗੜਾ ਸੰਗੀਤ ਦਾ ਇੱਕ ਕਹਿੰਦੇ ਬਹੁਤ ਸੰਗੀਤ ਅਤੇ ਨਾਚ ਦਾ ਬਹੁਤ ਹੀ ਖੂਬਸੂਰਤ ਮੇਲ ਹੈਗਾ ਇਹ ਜਿਹੜਾ ਲੋਕਾਂ ਨੂੰ ਨੱਚਣ ਦੇ ਲਈ ਪ੍ਰੇਰਿਤ ਕਰਦਾ ਹੈਗਾ ਅਤੇ ਉਹਨਾਂ ਨੂੰ ਖੁਸ਼ ਰੱਖਦਾ ਹੈਗਾ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਮੋਲ ਖਜ਼ਾਨਾ ਹੈ ਇਹ ਖੁਸ਼ੀ ਉਤਸ਼ਾਹ ਅਤੇ ਸਮਾਜਿਕ ਬੰਧਨਾਂ ਦਾ ਪ੍ਰਤੀਕ ਹੈ ਇਹ ਸਮੇਂ ਦੇ ਨਾਲ ਨਾਲ ਇਹ ਪੰਜਾਬੀ ਤਿਉਹਾਰਾਂ ਦਾ ਅਹਿਮ ਹਿੱਸਾ ਬਣ ਗਿਆ ਹੁਣ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਇੱਕ ਅਨਮੋਲ ਵਿਰਾਸਤ ਹੋਵੇਗਾ ਅਤੇ ਉਹ ਜਿਹੜੀਆਂ ਪੀੜ੍ਹੀਆਂ ਆਉਣ ਵਾਲੀਆਂ ਇਸਨੂੰ ਜ਼ਰੂਰ ਸਾਂਭ ਕੇ ਰੱਖਣਗੀਆਂ ਹਰ ਤਿਉਹਾਰ ਦੇ ਵਿੱਚ ਭੰਗੜਾ ਤਾਂ ਬਸ ਜਿੰਦ ਜਾਨ ਹੈ ਪੰਜਾਬੀਆਂ ਦੀ ਜੀ